ਹਾਂ ਹਾਂਜੀ ਵੀਰ ਜੀ ਹਾਂਜੀ ਦੱਸੋ ਜੀ ਹਾਂਜੀ ਵਧੀਆ ਵੀਰੇ ਤੁਸੀਂ ਦੱਸੋ ਹਾਂਜੀ ਹਾਂ ਠੀਕ ਆ ਵੀਰੇ ਹਾਂਜੀ ਪਲੰਬਰ ਦਾ ਕੰਮ ਬਾਕੀ ਆ ਹਾਂਜੀ ਹਾਂਜੀ ਹਾਂਜੀ ਠੀਕ ਆ ਜੀ ਟੈਂਕੀ ਦੇ ਨਾਲ ਏ ਲਗਾਉਣੀ ਆ ਹਾਂਜੀ ਹਾਂਜੀ ਠੀਕ ਆ ਹਾਂਜੀ ਠੀਕ ਆ ਵੀਰੇ ਹਾਂ ਹਾਂਜੀ ਰਸੋਈ 'ਚ ਛਿੰਕਾਂ ਦੇ ਨਾਲ ਲੱਗ ਜਾਣਗੀਆਂ ਹਾਂਜੀ ਹਾਂਜੀ ਠੀਕ ਆ ਵੀਰੇ ਕੋਈ ਗੱਲ ਨਹੀਂ ਹੋ ਜੂਗਾ

ਆਪਣੇ ਬਾਥਰੂਮ ਵਗੈਰਾ 'ਚ ਵੀ ਟੂਟੀਆਂ ਲੱਗਣਗੀਆਂ ਅਤੇ ਉੱਪਰ ਫੁਆਰਾ ਲਾਉਣਾ ਉੱਪਰ ਠੀਕ ਆ ਵੀਰੇ ਅਤੇ ਬਾਕੀ ਚਲੋ ਆਪਣੇ ਵਾਸ਼ਰੂਮ ਹੋ ਗਿਆ ਅਤੇ ਕਿਚਨ ਹੋ ਗਿਆ ਇੱਕ ਉਹ ਆਪਣੇ ਪਾਰਕ ਹੋ ਗਈ ਠੀਕ ਆ ਵੀਰੇ ਠੀਕ ਆ ਠੀਕ ਆ ਫਿਰ ਵੀਰੇ ਇੱਦਾਂ ਕਰਦੇ ਹਾਂ ਮੈਂ ਨਾ ਤੁਹਾਡੇ ਕੋਲ ਕੱਲ੍ਹ ਨੂੰ ਗੇੜ੍ਹਾ ਮਾਰਦਾ ਕੱਲ੍ਹ ਨੂੰ ਫਰੀ ਰਹੋ ਹਾਂ ਮੈਂ ਕੱਲ੍ਹ ਨੂੰ ਤੁਹਾਨੂੰ ਫੋਨ ਕਰਕੇ ਆਉਂਗਾ ਠੀਕ ਹੈ ਵੀਰੇ ਓਕੇ